ਫੋਟੋਗ੍ਰਾਫੀ ਨੂੰ ਸਰਗਰਮੀ ਜਾਂ ਸਮਾਜਿਕ ਤਬਦੀਲੀ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਕਿਉਂਕੀ ਇਹ ਇੱਕ ਸ਼ਕਤੀਸ਼ਾਲੀ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ ਜੋ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਛੂਹ ਸਕਦੀ ਹੈ ਅਤੇ ਸੱਚਾਈ ਨੂੰ ਸਾਹਮਣੇ ਲਿਆ ਸਕਦੀ ਹੈ ਇਹ ਸਾਨੂੰ ਸਮਾਜਿਕ ਮਸਲਿਆਂ ਦੀ ਵਾਖਵੀਅਤ ਲਈ ਲੋਕ ਲੋਕਾਂ ਦੇ ਲ ਹੱਕਾਂ ਦੀ ਹਿਮਾਇਤ ਲਈ ਅਤੇ ਸਮਾਜਿਕ ਅਤੇ ਸੱਭਿਆਚਾਰਕ ਚਿਤਾਮਨਾ ਨੂੰ ਵਧਾਉਣ ਲਈ ਵਰਤਿਆ ਜਾ ਸਕਦਾ ਹੈ ਫੋਟੋਗ੍ਰਾਫੀ ਦਾ ਪ੍ਰਯੋਗ ਸਮਾਜਿਕ ਤਬਦੀਲੀ ਲਈ ਜਾਗਰੂਕਤਾ ਉਤਪੰਨ ਕਰਨ ਲਈ ਵਰਤਿਆ ਜਾ ਸਕਦਾ ਹੈ ਫੋਟੋਗ੍ਰਾਫੀ ਦੁਨੀਆ ਦੇ ਮੋਹਰੇ ਅ ਤੇ ਸਥਿਤੀਆਂ ਜਿਵੇਂ ਕਿ ਗਰੀਬੀ ਦੰਗੇ ਜੰਗ ਅਤੇ ਵਾਤਾਵਰਨ ਮਸਲਿਆਂ ਨੂੰ ਦੱਸ ਸਕਦੇ ਹਨ ਇਸ ਨਾਲ ਲੋਕਾਂ ਨੂੰ ਸਮਾਜਿਕ ਅਤੇ ਸਿਆਸੀ ਚਤਾਂ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਫੋਟੋਗ੍ਰਾਫੀ ਹੱਥਬੰਦੀ ਤੋੜਨ ਲਈ ਵੀ ਕਾਫ਼ੀ ਜ਼ਿਆਦਾ ਫਾਇਦੇਮੰਦ ਹੈ ਫੋਟੋਗ੍ਰਾਫੀ ਮਨੁੱਖਤਾ ਨੂੰ ਜਨਮ ਦੇ ਸਕਦੀ ਹੈ ਅਤੇ ਲੋਕਾਂ ਨੂੰ ਵਿਅਕਤੀਗਤ ਅਤੇ ਸਮਾਜਿਕ ਪੱਧਰ 'ਤੇ ਜੋੜ ਸਕਦੀ ਹੈ ਇਹ ਲੋਕਾਂ ਵਿੱਚ ਸਹਿ ਸਹੂਤ ਚਰਨਾਂ ਲਈ ਅਤੇ ਅਨੇਕਤਾਵਾਂ ਨੂੰ ਮਨਜ਼ੂਰ ਕਰਨ ਲਈ ਵੀ ਪਿਆਰ ਭਰ ਸਕਦੀ ਹੈ ਫੋਟੋਗ੍ਰਾਫੀ ਮਾਣਕ ਹਿੱਕ ਹੱਕਾਂ ਦੀ ਹਿਮਾਇਤ ਕਰਨ ਲਈ ਕਾਫ਼ੀ ਫਾਇਦੇਮੰਦ ਹੈ ਫੋਟੋਗ੍ਰਾਫੀ ਆਪਣੇ ਕੰਮ ਦੁਆਰਾ ਮਾਨਵ ਹੱਕਾਂ ਦੀ ਉਲੰਘਣਾ ਅਤੇ ਸਮਾਜਿਕ ਅਨਿਆਏ ਦੇ ਵਿਰੋਧੀ ਵੀ ਕਰਦੀ ਹੈ ਫੋਟੋਗ੍ਰਾਫੀ ਰਾਹੀਂ ਅਸੀਂ ਆਪਣੇ ਪਸੰਦੀਦਾ ਸਲਾਗੋੜੋ ਦੇ ਗਰੀਬੀ ਦੰਗੇ ਅਤੇ ਵਾਤਾਵਰਨਕ ਮਸਲਿਆਂ ਦੇ ਬਾਰੇ ਦ੍ਰਿਸ਼ਟੀਕੋਣ ਪ੍ਰਦਾਨ ਕਰ ਸਕਦੇ ਹਾਂ ਫੋਟੋ ਦੋ ਗ੍ਰਾਫੀ ਦੁਆਰਾ ਖਿੱਚੀਆਂ ਗਈਆਂ ਇਮੇਜਾਂ ਜਿਵੇਂ ਸਿਰਫ਼ ਦ੍ਰਿਸ਼ਟੀਅਤ ਸੁੰਦਰ ਹੀ ਨਹੀਂ ਬਲਕਿ ਉਹ ਲੋਕਾਂ ਨੂੰ ਸੋਚਣ ਅਤੇ ਅਮਲ ਲਈ ਪ੍ਰੇਰਿਤ ਕਰਦੀਆਂ ਹਨ ਫੋਟੋਗ੍ਰਾਫੀ ਕਾਫ਼ੀ ਸ਼ਕਤੀਸ਼ਾਲੀ ਸਾਧਨ ਹੋ ਸਕਦੀ ਹੈ ਸਮਾਜਿਕ ਤਬਦੀਲੀ ਦੇ ਲਈ ਕਿਉਂਕਿ ਇਹ ਲੋਕਾਂ ਦੇ ਹਿੱਸੇ ਵਿੱਚ ਅਧੂਰਾਪਨ ਅਨਿਆਏ ਅਤੇ ਸਮਾਜਿਕ ਮਸਲਿਆਂ ਨੂੰ ਬੇਨਕਾਬ ਕਰ ਸਕਦੀ ਹੈ ਧੰਨਵਾਦ